ਹਾਂਜੀ ਬਿਲਕੁਲ ਅਸੀਂ ਜੋਮੈਟੋ ਅਤੇ ਸਵਿਗੀ ਦੀ ਵਰਤੋਂ ਜ਼ਰੂਰ ਕਰਦੇ ਹਾਂ ਫੂਡ ਡਿਲੀਵਰੀ ਵਰਗੇ ਐਪ ਦੀ ਵਰਤੋਂ ਜ਼ਰੂਰ ਕਰਦੇ ਹਾਂ ਇਸ ਦੇ ਫਾਇਦੇ ਅਤੇ ਨੁਕਸਾਨ ਵੀ ਹਨ ਖਾਣਾ ਪੀਣਾ ਵਧੀਆ ਲੱਗਦਾ ਹੈ ਅਸੀਂ ਵਧੀਆ ਤੋਂ ਵਧੀਆ ਰੈਸਟੋਰੈਂਟ ਤੋਂ ਆਪਣਾ ਭੋਜਨ ਮੰਗਵਾ ਸਕਦੇ ਹਾਂ ਜਦੋਂ ਕਿ ਅਸੀਂ ਘਰ ਬਿਜ਼ੀ ਹੁੰਦੇ ਹਾਂ ਅਤੇ ਆਪਾਂ ਜਦੋਂ ਵੀ ਕੋਈ ਵੀ ਬਾਹਰੋਂ ਖਾਣਾ ਮੰਗਵਾਉਣਾ ਹੁੰਦਾ ਵਾ ਅਤੇ ਆਪਾਂ ਮੰਗਵਾ ਲੈਂਦੇ ਹਾਂ ਅਤੇ ਜੇਕਰ ਅਸੀਂ ਬਿਜ਼ੀ ਹਾਂ ਅਤੇ ਬਾਹਰੋਂ ਮੰਗਵਾ ਲੈਂਦੇ ਹਾਂ ਜਿਹੜਾ ਕਿ ਸਾਡੇ ਘਰ ਅੱਧੇ ਪੌਣੇ ਘੰਟੇ ਵਿੱਚ ਜਿਹੜਾ ਵੀ ਰਾਈਡਰ ਹੈ ਸਵਿਗੀ ਡਿਲੀਵਰੀ ਐਪ ਤੋਂ ਜਾਂ ਜਮੈਟੋ ਡਿਲੀਵਰੀ ਐਪ ਤੋਂ ਆਪਾਂ ਮੰਗਵਾ ਸਕਦੇ ਹਾਂ ਖਾਣਾ ਘਰ ਅੱਧੇ ਪੌਣੇ ਘੰਟੇ ਤੱਕ ਸਾਡੇ ਕੋਲ ਆ ਜਾਂਦਾ ਅਤੇ ਅਸੀਂ ਖਾ ਪੀ ਕੇ ਅਰਾਮ ਨਾਲ ਆਪਣਾ ਜ਼ਰੂਰੀ ਕੰਮ ਕਰ ਸਕਦੇ ਹਾਂ ਜੇਕਰ ਸਾਡੇ ਕੋਲ ਬਣਾਉਣ ਦਾ ਟਾਈਮ ਨਹੀਂ ਹੈ ਤਾਂ ਇਹ ਹੋ ਗਿਆ ਸੁਵਿਧਾਜਨਕ ਹੁਣ ਅਸੁਵਿਧਾਜਨਕ ਸੁਣ ਲਓ ਸਾਡੇ ਕੋਲ ਜਿਵੇਂ ਵੀ ਸਾਨੂੰ ਘਰ ਆਪਾਂ ਵਿਹਲੇ ਬੈਠੇ ਹੁੰਦੇ ਹਾਂ ਸਾਡਾ ਮਨ ਨਹੀਂ ਕਰਦਾ ਕੁਛ ਵੀ ਚੀਜ਼ ਕਰਨ ਨੂੰ ਤੁਹਾਨੂੰ ਪਤਾ ਹੀ ਹੈ ਕਿ ਇਹ ਬਹੁਤ ਗਲਤ ਗੱਲ ਹੈਗੀ ਆ ਕਿ ਸਾਨੂੰ ਆਲਸ ਪੈ ਜਾਂਦਾ ਕਿਸੇ ਵੀ ਚੀਜ਼ ਦਾ ਆਪਾਂ ਵਾਰ ਵਾਰ ਸਵਿਗੀ ਤੋਂ ਮੰਗਵਾਈ ਜਾਵਾਂਗੇ ਖਾਣਾ ਸਾਨੂੰ ਫਿਰ ਉਸ ਚੀਜ਼ ਦੀ ਆਦਤ ਪੈ ਜਾਣੀ ਆ ਜੇ ਸਾਡੀ ਜੇਬ 'ਚ ਪੈਸੇ ਹੈਗੇ ਤਾਂ ਸਾਨੂੰ ਉਸ ਚੀਜ਼ ਦੀ ਵਾਰ ਵਾਰ ਅਸੀਂ ਮੰਗਵਾਈ ਜਾਵਾਂਗੇ ਤਾਂ ਸਾਨੂੰ ਆਦਤ ਪੈ ਜਾਣੀ ਕਿ ਯਾਰ ਕੱਲ੍ਹ ਨੂੰ ਮੰਗਵਾਇਆ ਸੀ ਚਲੋ ਅੱਜ ਫਿਰ ਮੰਗਾਉਂਦੇ ਹਾਂ ਸੋ ਇਸ ਚੀਜ਼ ਦੀ ਆਦਤ ਬਹੁਤ ਮਾੜੀ ਹੈ ਇਸਨੂੰ ਲਿਮਿਟ 'ਤੇ ਕੀਤਾ ਜਾਵੇ ਕਿਸ ਹਰ ਇੱਕ ਚੀਜ਼ ਨੂੰ ਲਿਮਿਟ 'ਚ ਕੀਤਾ ਜਾਵੇ ਤਾਂ ਹੀ ਉਹ ਵਧੀਆ ਰਹਿੰਦੀ ਹੈ ਨਹੀਂ ਤਾਂ ਨਹੀਂ ਤਾਂ ਨਹੀਂ ਸਹੀ ਰਹਿੰਦੀ ਸੋ ਇਸ ਨੂੰ ਬੈਲੈਂਸ ਰੱਖਣਾ ਚਾਹੀਦਾ ਹੈ ਦੋਵਾਂ ਚੀਜ਼ਾਂ ਨੂੰ ਬੈਲੈਂਸ ਰੱਖਣਾ ਚਾਹੀਦਾ ਹੈ ਲੋੜ ਪੈਣ 'ਤੇ ਹੀ ਔਨਲਾਈਨ ਸਮਾਨ ਮੰਗਵਾਓ ਖਾਓ ਠੀਕ ਹੈ ਫਾਲਤੂ ਖਰਚਾ ਨਾ ਕਰੋ ਆਲਸ ਨਾ ਆਲਸੀ ਨਾ ਬਣੋ